ਹੈਲੋ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਪਰਵੀਨ ਮੈਡਮ

ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਨਹੀਂ ਨਹੀਂ ਕੋਈ ਗੱਲ ਨਹੀਂ ਦੱਸੋ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਹਾਂਜੀ ਦੱਸੋ ਹਾਂਜੀ ਹਾਂਜੀ ਹਾਂਜੀ ਸਹਿਮਿਆ ਹੋਇਆ ਮਤਲਬ ਹਾਂ ਵੀ ਸ ਹਾਂ ਹਾਂ ਸਹਿਮਿਆ ਜਿਹਾ ਰਹਿੰਦਾ

ਹਾਂ ਹਾਂ ਮਤਲਬ ਇਹ ਸਮਝ ਲਓ ਵੀ ਉਹਦਾ ਦਿਮਾਗ ਉਸ ਟਾਈਮ ਕਿਤੇ ਹੋਰ ਹੁੰਦਾ ਜਾਂ ਉਹਦੇ ਦਿਮਾਗ 'ਚ ਕੁਛ ਹੋਰ ਚੱਲ ਰਿਹਾ ਹੁੰਦਾ ਹੈ ਨਾ ਹਾਂ ਨਹੀਂ ਹੁੰਦਾ ਮੈਮ

ਹਾਂ ਤੁਸੀਂ ਮੈਡਮ ਉਹਨੂੰ ਅਲੱਗ ਬੁਲਾ ਕੇ ਹੈ ਨਾ ਅ ਕਿਸੇ ਸਟਾਫ ਰੂਮ 'ਚ ਜਾਂ ਕਿਸੇ ਵੀ ਰੂਮ 'ਚ ਤੁਸੀਂ ਉਹਦੇ ਨਾਲ ਇਹ ਗੱਲਬਾਤ ਕਰੋ ਵੀ ਉਹਨੂੰ ਮਤਲਬ ਘਰ ਤਾਂ ਨਹੀਂ ਕੋਈ ਪ੍ਰੋਬਲਮ ਹੈਗੀ ਜਾਂ ਘਰ ਕੋਈ ਸਮੱਸਿਆ ਉਹਨੂੰ ਹੋਵੇ ਹੈ ਨਾ ਜਾਂ ਉਹਦੇ ਘਰ ਦਾ ਮਾਹੌਲ ਕਿਹੋ ਜਿਹਾ ਜਾਂ ਵੀ ਉਹਦੇ ਹਾਂ ਉਹਦੇ ਪਰਿਵਾਰਿਕ ਮੈਂਬਰਾਂ ਦਾ ਆਪਸ ਮੇਂ ਗੱਲਬਾਤ ਕਿਵੇਂ ਆ ਜਾਂ ਘਰ ਘਰ 'ਚ ਕਿੱਦਾਂ ਦੇ ਹਾਲਾਤ ਨੇ ਕਈ ਵਾਰੀ ਨਾ ਬੱਚਾ ਉਹ ਚੀਜ਼ ਨੂੰ ਦੱਸ ਨਹੀਂ ਸ ਰਿਹਾ ਹੁੰਦਾ ਵੀ ਘਰ ਉਹਨੂੰ ਕੋਈ ਦਿੱਕਤ ਹੁੰਦੀ ਹੈ ਹੈ ਨਾ ਤੁਸੀਂ ਇੱਕ ਵਾਰੀ ਉਹਨੂੰ ਬੁਲਾ ਕੇ ਇਹ ਇਹ ਗੱਲਬਾਤ ਪੁੱਛੋ ਉਹ ਤੋਂ ਇੱਕ ਵਾਰੀ ਹੈ ਨਾ ਮੈਨੂੰ ਇਹ ਲੱਗਦਾ ਵੀ ਜੇ ਆਪਾਂ ਪੁੱਛੀਏ ਜੇ ਤੁਸੀਂ ਨਾ ਥੋੜ੍ਹਾ ਉਹ ਦੇ ਕਲੋਜ਼ ਹੋਵੋ ਮੈਡਮ ਥੋੜ੍ਹਾ ਜਿਹਾ ਜਿਵੇਂ ਦੋਸਤਾਂ ਵਾਲਾ ਵਿਵਹਾਰ ਹੈ ਨਾ ਹਾਂ ਤੋ ਤੁਸੀਂ ਨਾ ਉਹਨੂੰ ਆਪਦੇ ਵਿਸ਼ਵਾਸ 'ਚ ਲਓ ਤੁਸੀਂ ਨਾ ਆਪਣੇ ਭਰੋਸੇ 'ਚ ਲਓ ਤਾਂ ਕਿ ਤੁਹਾਨੂੰ ਦੱਸ ਦੱਸ ਸਕੇ ਹੈ ਨਾ ਇਹ ਗੱਲਾਂ ਨੂੰ ਵੀ ਕਿ ਉਹਨੂੰ ਮਤਲਬ ਕਿ ਕਿਉਂ ਨਹੀਂ ਇਹ ਚੀਜ਼ ਸਮਝ ਆ ਰਹੀ ਕੋਈ ਇਕੱਲਾ ਪੜ੍ਹਾਈ ਪੱਖੋਂ ਹੀ ਉਹਦਾ ਦਿਮਾਗ ਐਪਸੈਂਟ ਰਹਿੰਦਾ ਜਾਂ ਕੋਈ ਉਹਦੇ ਦਿਮਾਗ 'ਚ ਕੋਈ ਮੁਸ਼ਕਿਲ ਚੱਲ ਰਹੀ ਹੈ ਕੋਈ ਸਮੱਸਿਆ ਚੱਲ ਰਹੀ ਹੈ ਹੈ ਨਾ ਹਾਂ ਤੁਸੀਂ ਹਾਂ ਤੁਸੀਂ ਇੱਕ ਵਾਰੀ ਤਾਂ ਉਹਦੇ ਨਾਲ ਇਹ ਗੱਲ ਕਰਕੇ ਦੇਖੋ ਉਸ ਤੋਂ ਬਾਅਦ ਫਿਰ ਬਾਈ ਚਾਂਸ ਚਲੋ ਕਿਸੇ ਟੀਚਰ ਨਾਲ ਬੱਚੇ ਦਾ ਹੋਰ ਜ਼ਿਆਦਾ ਲਗਾਅ ਹੁੰਦਾ ਤੁਸੀਂ ਉਸ ਟੀਚਰ ਨਾਲ ਗੱਲ ਕਰਕੇ ਦੇਖ ਲਓ ਉਹਦੇ ਬਾਰੇ ਹੈ ਨਾ ਹਾਂ ਕਿਉਂਕਿ ਇੱਕ ਨਾ ਅੱਧਾ ਟੀਚਰ ਤਾਂ ਹਾਂਜੀ ਹਾਂ ਹਾਂ ਨਹੀਂ ਨਹੀਂ ਹਾਂ ਮੈਡਮ ਇੱਦਾਂ ਦੇ ਕੇਸ ਹਾਂ ਹਾਂ ਹਾਂ ਨਹੀਂ ਇੱਦਾਂ ਦੇ ਕੇਸ ਨਾ ਹੋ ਜਾਂਦੇ ਨੇ ਹਾਂ ਮਤਲਬ ਸਾਰੇ ਸਕੂਲਾਂ 'ਚ ਹੀ ਇੱਦਾਂ ਦਾ ਹੁੰਦਾ ਮੈਂ ਸਾਡੇ ਵੀ ਹੋ ਜਾਂਦਾ ਕਈ ਵਾਰੀ ਤੇ ਨਾ ਜਿਵੇਂ ਹੁਣ ਬੱਚੇ ਤਾਂ ਕੋਈ ਪੱਕਾ ਮਿੱਤਰ ਹੋਵੇ ਜਾਂ ਸਹੇਲੀ ਹੋਵੇ ਹੈ ਨਾ ਕੁੜੀ ਹੋਵੇ ਅਤੇ ਮਤਲਬ ਉਹ ਹਾਂ ਉਹ ਵੀ ਦੱਸ ਸਕਦਾ ਹੈ ਨਾ ਵੀ ਉਹਨੂੰ ਪੁੱਛ ਲਵੇ ਵੀ ਬੱਚੇ ਕਈ ਵਾਰੀ ਅਧਿਆਪਕ ਨੂੰ ਬੱਚਾ ਨਹੀਂ ਵੀ ਦੱਸਦਾ ਹੁੰਦਾ ਕੋਈ ਗੱਲਬਾਤ ਨਾ ਜਾਂ ਉਹਨੂੰ ਕੋਈ ਸਰੀਰਕ ਪੱਖੋਂ ਕੋਈ ਦਿੱਕਤ ਹੈ ਹੈ ਨਾ ਕਈ ਵਾਰੀ ਬੱਚਾ ਸ਼ਰਮਾ ਜਾਂਦਾ ਨਹੀਂ ਵੀ ਪਤਾ ਲੱਗਦਾ ਹੁੰਦਾ ਤਾਂ ਆਪਣੇ ਨਾਲ ਦੇ ਸਾਥੀਆਂ ਨੂੰ ਕਿਸੇ ਨੂੰ ਉਹ ਦੱਸ ਦੇਵੇ ਤਾਂ ਜਿਸ ਤੋਂ ਤੁਹਾਨੂੰ ਪਤਾ ਲੱਗ ਸਕੇ ਹੈ ਨਾ ਡਰਿਆ ਹੋਇਆ ਹਾਂ ਜਾਂ ਫਿਰ ਇੱਕ ਲਾਸਟ ਤਰੀਕਾ ਇਹ ਮੈਡਮ ਵੀ ਉਹਦੇ ਘਰ ਦੇ ਮੈਂਬਰ ਨੂੰ ਕਿਸੇ ਨੂੰ ਵੀ ਸੱਦ ਕੇ ਉਹਨਾਂ ਨੂੰ ਕੌਂਸਲ ਕੀਤਾ ਜਾਵੇ ਹੈ ਨਾ ਉਹਨਾਂ ਤੋਂ ਪੁੱਛਿਆ ਜਾਵੇ ਹਾਂ ਕਿਉਂਕਿ ਦੇਖੋ ਜਦੋਂ ਜੇ ਤਾਂ ਬੱਚਾ ਵੈਸੇ ਹੀ ਦਿਮਾਗੀ ਤੌਰ 'ਤੇ ਹੋਵੇ ਨਾ ਫਿਰ ਤਾਂ ਉਹ ਬਾਕੀ ਇਕੱਲੇ ਜੇ ਇਕੱਲੇ ਤੌਰ 'ਤੇ ਵੀ ਨਾ ਨਾ ਚੰਗੀ ਤਰ੍ਹਾਂ ਤੁਹਾਡੇ ਨਾਲ ਗੱਲ ਕਰੇ ਜਦੋਂ ਤੁਸੀਂ ਕਹਿੰਦੇ ਹੋਏ ਹਾਂ ਹਾਂ ਹਾਂ ਹਾਂ ਜਾਂ ਹੋ ਸਕਦਾ ਮੈਡਮ ਉਹ ਨੂੰ ਕੋਈ ਕਲਾਸ 'ਚ ਦਿੱਕਤ ਹੋਵੇ ਕੋਈ ਬੱਚੇ ਤੋਂ ਜਾਂ ਹੈ ਨਾ ਕਿਸੇ ਤੋਂ ਕਹਿ ਲਓ ਵੀ ਇਹ ਇਸ ਤਰ੍ਹਾਂ ਦਾ ਹਾਂ ਤੁਸੀਂ ਨਾ ਇੱਦਾਂ ਹੀ ਕਰਕੇ ਦੇਖੋ ਜਾਂ ਤਾਂ ਉਹਨੂੰ ਇਕੱਲੇ ਨੂੰ ਬੁਲਾ ਕੇ ਤੁਸੀਂ ਪੁੱਛੋ ਜਾਂ ਕਿਸੇ ਨਾਲ ਦੇ ਬੱਚੇ ਨੂੰ ਉਹਦਾ ਸਾਥੀ ਜਿਹੜਾ ਉਹਦਾ ਵਧੀਆ ਸਾਥੀ ਆ ਉਹਦੀ ਕਿਸੇ ਦੀ ਡਿਊਟੀ ਜ਼ਿੰਮੇਵਾਰੀ ਲਾ ਦਿਓ ਹੈ ਨਾ ਅਤੇ ਇਹ ਹੀ ਇਕ ਅਸੀ ਹਾਜੀਂ ਨਹੀਂ ਕੋਈ ਗੱਲ ਨਹੀਂ ਮੈਡਮ ਹੁਣ ਜ ਹਾਂ ਨਹੀਂ ਮੈਡਮ ਦੇਖੋ ਇਹ ਮਾਮਲਾ ਤਾਂ ਇਹ ਬਹੁਤ ਸੀਰੀਅਸ ਹੀ ਹੁੰਦਾ ਬੱਚੇ ਦਾ ਮਾਮਲਾ ਦੇਖੋ ਹੁਣ ਜੇ ਆਪਾਂ ਰਲ ਮਿਲ ਕੇ ਨਹੀਂ ਸੁਲਝਾਵਾਂਗੇ ਤਾਂ ਫਿਰ ਆਪਣਾ ਫਾਇਦਾ ਵੀ ਕੀ ਹੈ ਹੈ ਨਾ ਅਤੇ ਕਿਉਂਕਿ ਅਧਿਆਪਕ ਤਾਂ ਬੱ ਹਾਂ ਹਾਂ ਕਿਉਂਕਿ ਅਧਿਆਪਕ ਤਾਂ ਬੱਚੇ ਦੇ ਦੂਜੇ ਮਾਂ ਬਾਪ ਹੁੰਦੇ ਨੇ ਤਾਂ ਨਹੀਂ ਕੋਈ ਗੱਲ ਨਹੀਂ ਤੁਸੀਂ ਜਦੋਂ ਮਰਜ਼ੀ ਕਾਲ ਕਰਿਓ ਹਾਂਜੀ ਹਾਂ ਜਦੋਂ ਹਾਂ ਅਤੇ ਮੈਨੂੰ ਜ਼ਰੂਰ ਦੱਸਿਓ ਮੈਡਮ ਜੇ ਉਹਦਾ ਕੋਈ ਹੱਲ ਨਿਕਲਦਾ ਹੈ ਹੈ ਨਾ ਹਾਂਜੀ ਠੀਕ ਹੈ ਮੈਡਮ ਓਕੇ ਜੀ ਓਕੇ ਨਹੀਂ ਕੋਈ ਗੱਲ ਨਹੀਂ ਮੈਡਮ ਮੋਸਟ ਵੈਲਕਮ